ਖ਼ੇਡਾਂ ਬਾਰੇ ਪੇਂਡੂ ਲੋਕਾਂ ਦੀ ਆਪਣੀ ਹੀ ਰਾਏ ਹੈ ਇਹ ਬੜੇ ਹੀ ਸਿੱਧੇ ਸਾਧੇ ਲੋਕ ਹਨ ਜ਼ਿਆਦਾਤਰ ਖੇਡ ਜੋ ਅਜ਼ਮਾਈ ਵਾਲੀ ਪਸੰਦ ਕਰਦੇ ਹਨ ਉਹਨਾਂ ਨੂੰ ਖੇਡਣ ਲਈ ਹੀ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹਨ ਜਿਵੇਂ ਕਿ ਕਬੱਡੀ ਕੁਸ਼ਤੀ ਵਾਲੀਬਾਲ ਆਦਿ ਜਿਨ੍ਹਾਂ ਨੂੰ ਖੇਡ ਕੇ ਸਰੀਰਿਕ ਤੰਦਰੁਸਤੀ ਅਤੇ ਚੁਸਤੀ ਪ੍ਰਾਪਤ ਹੁੰਦੀ ਹੈ ਸਮੇਂ ਸਮੇਂ ਉੱਤੇ ਇਹ ਆਪਣੀ ਪੁਰਾਣੀਆਂ ਖੇਡਾਂ ਨੂੰ ਅੱਜ ਦੇ ਸਮੇਂ ਵਿੱਚ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹਨਾਂ ਖੇਡਾਂ ਨੂੰ ਖੇਡ ਕੇ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਨ ਇਹ ਸਭ ਖੇਡਾਂ ਸਰੀਰਿਕ ਜ਼ੋਰ ਮੰਗਦੀਆਂ ਹਨ ਅਤੇ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਹਨ ਕਿ ਇਹਨਾਂ ਨੂੰ ਅੱਗੇ ਇਹਨਾਂ ਖੇਡਾਂ ਨੂੰ ਅੱਗੇ ਲਿਆਂਦਾ ਜਾਵੇ ਅਤੇ ਇਹਨਾਂ ਨੂੰ ਖੇਡਣ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ